ਨਹੀਂ ਮੈਨੂੰ ਕਦੇ ਵੀ ਪੰਜਾਬੀ ਲਿਖਣ ਜਾਂ ਫਿਰ ਬੋਲਣ ਵੇਲੇ ਕਦੇ ਵੀ ਕੋਈ ਮੁਸ਼ਕਿਲ ਨਹੀਂ ਆਈ ਇੱਦਾਂ ਕਿਉਂਕਿ ਜਦੋਂ ਅਸੀਂ ਨਿੱਕੇ ਹੁੰਦੇ ਸੀ ਤਾਂ ਮੰਮਾ ਸਾਨੂੰ ਜਿਹੜੇ ਸੀਗੇ ਵਰਨਮਾਲਾ ਦੇ ਜਿਹੜੇ ਅੱਖਰ ਹੈਗੇ ਆ ਊੜਾ ਐੜਾ ਜਾਂ ਫਿਰ ਜੋ ਬਾਕੀ ਵੀ ਉਹਨਾਂ ਦੇ ਕੀ ਸੀਗੀ ਪ੍ਰੈਕਟਿਸ ਕਰਵਾਉਂਦੇ ਰਹਿੰਦੇ ਸੀਗੇ ਇਸ ਤੋਂ ਇਲਾਵਾ ਜੋ ਲਗਾ ਮਾਤਰਾਵਾਂ ਹੈਗੀਆਂ ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਇਹਨਾਂ ਦੀ ਵੀ ਪ੍ਰੈਕਟਿਸ ਕਰਵਾਉਂਦੇ ਸੀ ਵੀ ਇਹਨਾਂ ਦਾ ਯੂਜ ਕਿੱਦਾਂ ਕਰਨਾ ਜਾਂ ਇਹਨਾਂ ਦੀ ਆਵਾਜ਼ ਕੀ ਆ ਜਾਂ ਅੱਖਰ ਦੇ ਨਾਲ ਰਲ ਕੇ ਇਹ ਕਿਸ ਤਰ੍ਹਾਂ ਦੀ ਆਵਾਜ਼ ਕੱਢਦੇ ਆ ਇਸ ਤੋਂ ਇਲਾਵਾ ਲਗਾਖਰ ਜੋ ਹੁੰਦੇ ਆ ਬਿੰਦੀ ਟਿੱਪੀ ਅੱਧਕ ਉਹਨਾਂ ਦੀ ਕਿੱਦਾਂ ਵਰਤੋਂ ਕਰਨੀ ਆ ਇਹ ਵੀ ਜਿਹੜਾ ਵਾ ਸਾਨੂੰ ਸ਼ੁਰੂ ਤੋਂ ਸਿਖਾਇਆ ਗਿਆ ਹੈ ਇਸ ਕਰਕੇ ਕੀ ਹੁੰਦਾ ਏ ਕਿ ਨਾਲ ਨਾਲ ਫਿਰ ਪ੍ਰੈਕਟਿਸ ਹੁੰਦੀ ਰਹਿੰਦੀ ਹੈ ਜਿੱਦਾਂ ਆਪਣੀਆਂ ਸਕੂਲ ਦੇ ਵਿੱਚ ਕਲਾਸਿਸ ਅੱਗੇ ਅੱਗੇ ਵੱਧਦੀਆਂ ਰਹਿੰਦੀਆਂ ਹਰ ਸਾਲ ਅਤੇ ਫਿਰ ਉਹ ਨਾਲ ਨਾਲ ਜਿਹੜੀ ਘਰ ਵੀ ਪ੍ਰੈਕਟਿਸ ਹੁੰਦੀ ਆ ਸਕੂਲ ਵੀ ਪ੍ਰੈਕਟਿਸ ਹੁੰਦੀ ਆ ਅਤੇ ਕਦੇ ਵੀ ਜਿਹੜਾ ਵਾ ਉਹ ਪ੍ਰੋਬਲਮ ਨਹੀਂ ਆਉਂਦੀ ਸਗੋਂ ਨਵੇਂ ਤੋਂ ਨਵੇਂ ਵਰਡਸ ਜਿਹੜੇ ਆ ਉਹ ਸਿੱਖਣ ਨੂੰ ਮਿਲਦੇ ਆ ਹੁਣ ਪੰਜਾਬੀ ਆਪਾਂ ਨੋਰਮਲੀ ਆਪਣੇ ਘਰ ਵੀ ਬੋਲਦੇ ਹਾਂ ਆਪਣੀ ਮਾਤ ਭਾਸ਼ਾ ਪੰਜਾਬੀਆਂ ਦੀ ਅਤੇ ਉਹ ਜਦੋਂ ਵੀ ਆਪਾਂ ਵਰਡਸ ਬੋਲਦੇ ਹਾਂ ਘਰ ਆਪਸ ਵਿੱਚ ਗੱਲਬਾਤ ਕਰਦੇ ਹਾਂ ਜਾਂ ਯੂਜ ਕਰਦੇ ਹਾਂ ਉਹਨਾਂ ਦਾ ਅਤੇ ਉਦੋਂ ਕੀ ਹੁੰਦਾ ਏ ਨਿੱਕੇ ਹੁੰਦੇ ਜੋ ਪ੍ਰੈਕਟਿਸ ਕੀਤੀ ਹੁੰਦੀ ਆ ਕਿ ਇਹਨਾਂ ਦੀ ਆਵਾਜ਼ ਕਿੱਦਾਂ ਲੱਗਣੀ ਜਾਂ ਅੱਖਰ ਨਾਲ ਕਿੱਦਾਂ ਲਗਾਉਣਾ ਏ ਉਹ ਨਾਲ ਨਾਲ ਗੱਲ ਕਰਦਿਆਂ ਕਰਦਿਆਂ ਆਪਣੇ ਆਪ ਹੀ ਮਾਇੰਡ ਵਿੱਚ ਰਿਪੀਟ ਹੋ ਜਾਂਦਾ ਏ ਕਿ ਇਹਨੂੰ ਕਿਸ ਤਰ੍ਹਾਂ ਬੋਲਣਾ ਜਾਂ ਕਿਸ ਤਰ੍ਹਾਂ ਲਿਖਣਾ ਏ ਇਸ ਕਰਕੇ ਮੈਨੂੰ ਕਦੇ ਵੀ ਪੰਜਾਬੀ ਲਿਖਣ ਜਾਂ ਫਿਰ ਬੋਲਣ ਵੇਲੇ ਕਦੇ ਵੀ ਕੋਈ ਵੀ ਮੁਸ਼ਕਿਲ ਨਹੀਂ ਆਈ ਕਿਉਂਕਿ ਇਹ ਸ਼ੁਰੂ ਤੋਂ ਹੀ ਸਾਡੇ ਨਾਲ ਜਿਹੜੀ ਜੁੜੀ ਹੋਈ ਹੈ ਅਸੀਂ ਸਟਾਰਟਿੰਗ ਤੋਂ ਇਹਨੂੰ ਘਰੋਂ ਹੀ ਸਿੱਖਿਆ ਹੋਇਆ ਹੈ ਅਤੇ ਹੁਣ ਤੱਕ ਵੀ ਅਸੀਂ ਕੁਝ ਨਾ ਕੁਝ ਨਵੇਂ ਵਰਡਸ ਜਿਹੜੇ ਆ ਉਹ ਸਿੱਖਦੇ ਆਏ ਹਾਂ ਅਤੇ ਇਸ ਕਰਕੇ ਇਹ ਜਿਹੜੀ ਲਿਖਣ ਜਾਂ ਬੋਲਣ ਵੇਲੇ ਵੀ ਸਾਨੂੰ ਸੌਖੀ ਲੱਗਦੀ ਆ ਅਤੇ ਕੋਈ ਵੀ ਮੁਸ਼ਕਿਲ ਨਹੀਂ ਆਉਂਦੀ